ਪੰਜਾਬ ਵਿੱਚ ਪ੍ਰਮੁੱਖ ਸੰਸਥਾਵਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਕਿ ਜੋ ਕਿ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਉੱਪਰ ਤੱਕ ਪਹੁੰਚਾਉਂਦੀਆਂ ਹਨ ਅਤੇ ਉਹਨਾਂ ਦੇ ਹਿੱਤਾਂ ਦੀ ਹਿੱਤਾਂ ਲਈ ਜੋ ਵੀ ਕੋਸ਼ਚਨ ਉਹਨਾਂ ਦੇ ਉਹਨਾਂ ਅਤੇ ਸਰਕਾਰ ਤੱਕ ਪਹੁੰਚਾਉਂਦੀਆਂ ਹਨ ਪਰ ਇਸ ਟਾਈਮ ਵਿੱਚ ਮੈਨੂੰ ਇੱਕੋ ਹੀ ਯਾਦ ਹੈ ਜੋ ਕਿ ਥੋੜ੍ਹੇ ਸਮੇਂ ਵਿੱਚ ਪਹਿਲਾਂ ਥੋੜ੍ਹੇ ਸਮੇਂ ਪਹਿਲਾਂ ਹੀ ਹੋਈ ਸੀ ਵੀ ਕੇ ਯੂ ਜੋ ਜਿ ਜਿਸ ਵਿੱਚ ਉਹਨੇ ਕਿਸਾਨਾਂ ਨੇ ਦਿੱਲੀ ਵਿੱਚ ਜਾ ਕੇ ਆਪਣਾ ਬਹੁਤ ਹੀ ਵੱਡਾ ਧਰਨਾ ਦਿੱਤਾ ਸੀ ਜਿਹਦੇ ਵਿੱਚ ਉਹਨਾਂ ਨੇ ਆਪਣੇ ਹਿੱਤਾਂ ਦੀ ਜਾਂ ਆਪਣੇ ਮੰਗਾਂ ਜੋ ਵੀ ਉਹਨਾਂ ਦੇ ਉਹਨਾਂ ਨੇ ਸਰਕਾਰ ਦੇ ਅੱਗੇ ਰੱਖੀਆਂ ਜਿਹਦੇ ਵਿੱਚ ਉਹਨਾਂ ਨੇ ਕਾਫੀ ਸਮੇਂ ਤੱਕ ਆਪਣਾ ਧਰਨਾ ਲਗਾਇਆ ਰੱਖਿਆ ਬਹੁਤ ਸਾਰੇ ਉੱਚੇ ਉੱਚੇ ਅਹੁਦੇ 'ਤੇ ਜਿਹੜੇ ਲੋਕ ਸੀਗੇ ਉਹ ਵੀ ਉੱਥੇ ਜਾ ਕੇ ਉਹਨਾਂ ਕਿਸਾਨਾਂ ਵਿੱਚ ਸ਼ਾਮਿਲ ਹੋਏ ਜਿਹਦੇ ਕਰਕੇ ਉਹਨਾਂ ਦਾ ਕਿਸਾਨਾਂ ਦਾ ਹੌਂਸਲਾ ਹੋਰ ਵੀ ਵਧਿਆ ਜਿਹਦਾ ਕਿ ਉਹ ਆਪਣੀ ਮੰਗਾਂ ਜਾਂ ਆਪਣੇ ਮੰਗਾਂ ਦੇ ਲਈ ਅਪ ਉੱਥੇ ਬੈਠੇ ਰਹੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਸਰਕਾਰ ਨੇ ਪੂਰੀਆਂ ਨਹੀਂ ਕੀਤੀਆਂ